ਹੈਲੋ ਸਰ ਫਲਿਪ ਫਲਿਪਕਾਰਟ ਤੋਂ ਬੋਲ ਰਹੇ ਹੋ ਮੈਂ ਸਰ ਅੰਮਰ ਅੰਮ੍ਰਿਤਸਰ ਤੋਂ ਬੋਲ ਰਿਹਾ ਹਾਂ ਮੈਂ ਦੋ ਦਿਨ ਪਹਿਲਾਂ ਆਪਣਾ ਇੱਕ ਔਡਰ ਪਲੇਸ ਕੀਤਾ ਸੀਗਾ ਇਹ ਕੁੜਤੀਆਂ ਦੇ ਔਡਰ ਸੀ ਪਰ ਜੋ ਤੁਸੀਂ ਫੋਟੋਗ੍ਰਾਫ ਉਸ 'ਤੇ ਪਾਈਆਂ ਸੀ ਉਹਦੇ ਅਕੋਰਡਿੰਗਲੀ ਮੇਰੇ ਕੋਲ ਸਮਾਨ ਨਹੀਂ ਪਹੁੰਚਿਆ ਅਤੇ ਬੜਾ ਹੀ ਲੋਅ ਕੁਆਲਿਟੀ ਆਫ ਮਤਲਬ ਕਿ ਪ੍ਰੋਡਕਟ ਸੀਗਾ ਅਤੇ ਮੈਨੂੰ ਜੋ ਉੱਥੇ ਤੁਸੀਂ ਫੋਟੋਆਂ ਪਾਈਆਂ ਉਸ ਹਿਸਾਬ ਨਾਲ ਨਹੀਂ ਸੀ ਅਤੇ ਨਾ ਉਹ ਕਲਰ ਜੋ ਮੈਂ ਸਲੈਕਟ ਕੀਤਾ ਸੀ ਉਹ ਆਇਆ ਨਾ ਮੈਨੂੰ ਟਾਈਮ ਸਿਰ ਪ੍ਰੋਡਕਟ ਡਿਲੀਵਰ ਹੋਇਆ ਮੈਂ ਅੱਗੇ ਕਿਸੇ ਨੂੰ ਗਿਫਟ ਕਰਨਾ ਸੀ ਅਤੇ ਪਰ ਉਹ ਕੁ ਕੁਆਲਿਟੀ ਐਸੀ ਹੈ ਮੈਂ ਕਿਸੇ ਨੂੰ ਗਿਫਟ ਵੀ ਨਹੀਂ ਕਰ ਸਕਦਾ ਇਸ ਕਰਕੇ ਮੈਂ ਉਹਨੂੰ ਰਿਟਰਨ ਪਾ ਰਿਹਾ ਹਾਂ ਅਤੇ ਤੁਸੀਂ ਮੇਰਾ ਐਜ ਅਰਲੀ ਐਜ ਪੋਸੀਬਲ ਮੇਰਾ ਤੁਸੀਂ ਉਹ ਰਿਟਰਨ ਅਸੈਪਟ ਕਰੋ ਅਤੇ ਮੇਰੇ ਪੈਸੇ ਰਿਫੰਡ ਕਰੋ ਤਾਂ ਕਿ ਮੈਂ ਆਪਣੀ ਸ਼ੋਪਿੰਗ ਕਿਸੇ ਹੋਰ ਜਗ੍ਹਾ ਤੋਂ ਕਰ ਸਕਾਂ ਤਾਂ ਕਿ ਮੈਂ ਆਪਣਾ ਬਲ ਜੋ ਕਿਸੇ ਨੂੰ ਗਿਫਟ ਕਰਨਾ ਟਾਈਮ ਸਿਰ ਮੇਰਾ ਗਿਫਟ ਤਿਆਰ ਹੋਵੇ ਅਤੇ ਧੰਨਵਾਦ ਜੀ